ਪੰਜਾਬੀ ਜਿਹੜੀ ਭਾਸ਼ਾ ਹੈ ਉਹ ਬਹੁਤ ਹੀ ਸਰਲ ਅਤੇ ਸੁਖਾਲੀ ਭਾਸ਼ਾ ਹੈ ਹਰ ਪੰਜਾਬ ਦਾ ਵਿਅਕਤੀ ਪੰਜਾਬੀ ਬੋਲਦਾ ਹੈ ਪਰ ਖਿੱਤਿਆਂ ਦੇ ਜਿਵੇਂ ਵੰਡੇ ਜਾਣ ਦੇ ਕਾਰਣ ਥੋੜ੍ਹੀ ਥੋੜ੍ਹੀ ਦੂਰੀ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਵੀ ਜਿਹੜਾ ਭਾਸ਼ਾ ਦਾ ਹੈ ਉਹ ਫ਼ਰਕ ਪੈ ਜਾਂਦਾ ਹੈ ਜਿਵੇਂ ਭਾਸ਼ਾ ਨੂੰ ਕਈ ਪੱਧਰਾਂ 'ਤੇ ਵੰਡਿਆ ਗਿਆ ਹੈ ਮਾਝੀ ਮਲਵਈ ਦੁਆਬੀ ਪੁਆਧੀ ਹੋ ਗਈ ਤਾਂ ਜੇ ਦੇਖਿਆ ਜਾਵੇ ਜੇਕਰ ਕੋਈ ਵਿਦੇਸ਼ੀ ਜਾਂ ਕਿਸੇ ਹੋਰ ਸਟੇਟ ਦਾ ਕੋਈ ਹੋਰ ਰਾਜ ਦਾ ਜਿਹੜਾ ਵਿਅਕਤੀ ਹੈ ਜਦੋਂ ਸਾਡੇ ਪੰਜਾਬ ਦੇ ਵਿੱਚ ਆਉਂਦਾ ਹੈ ਜਾਂ ਉਹ ਇੱਥੇ ਪੜ੍ਹਾਈ ਕਰਨ ਦੇ ਲਈ ਆਉਂਦਾ ਹੈ ਕੋਈ ਕੰਮ ਕਰਨ ਦੇ ਲਈ ਆਉਂਦਾ ਹੈ ਤਾਂ ਜਿਹੜੇ ਸਾਡੇ ਪੰਜਾਬੀ ਲੋਕ ਹਨ ਤਾਂ ਉਨ੍ਹਾਂ ਦੀ ਇੱਕੋ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜਾ ਹੈ ਉਹਨਾਂ ਨੂੰ ਗੱਲ ਕਰਨ ਦੇ ਲਈ ਕਿਵੇਂ ਸਮਝਾਇਆ ਜਾਵੇ ਤਾਂ ਸਭ ਤੋਂ ਸਰਲ ਤਰੀਕੇ ਨਾਲ ਸਮਝਾਉਣ ਦੀ ਜਿਹੜੀ ਉਹਨਾਂ ਦੀ ਖੁਦ ਦੀ ਭਾਸ਼ਾ ਦੇ ਵਿੱਚ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੰਜਾਬੀ ਲੋਕ ਇੱਕ ਰਲੌਟੀ ਭਾਸ਼ਾ ਜਿਹੜੀ ਰਲਮੀ ਮਿਲਵੀਂ ਭਾਸ਼ਾ ਉਹਨਾਂ ਦੀ ਭਾਸ਼ਾ ਦੇ ਵਿੱਚ ਪੰਜਾਬੀ ਨੂੰ ਮਿਲਾ ਕੇ ਬੋਲਣ ਦੀ ਕੋਸ਼ਿਸ਼ ਕਰਦੇ ਹਨ ਜਿਵੇ ਅਸੀਂ ਸਮਝਦੇ ਹਾਂ ਜੇਕਰ ਕੋਈ ਯੂ ਪੀ ਬਿਹਾਰ ਦੇ ਜਿਹੜੇ ਲੋਕ ਨੇ ਵਿਅਕਤੀ ਇੱਧਰ ਕੰਮ ਧੰਦੇ ਦੇ ਲਈ ਆਉਂਦੇ ਨੇ ਤਾਂ ਉਹ ਪੰਜਾਬੀ ਜਿਹੜੇ ਲੋਕ ਨੇ ਉਹਨਾਂ ਨਾਲ ਗੱਲ ਕਰਨ ਦੇ ਲਈ ਉਹਨਾਂ ਦੀ ਹਿੰਦੀ ਭਾਸ਼ਾ ਦੇ ਵਿੱਚ ਗੱਲ ਕਰਨ ਦੀ ਕੋਸਿਸ਼ ਕਰਦੇ ਨੇ ਅਤੇ ਉਹਨਾਂ ਦੀ ਭਾਸ਼ਾ ਦੇ ਵਿੱਚ ਆਪਣੀ ਪੰਜਾਬੀ ਮਾਂ ਬੋਲੀ ਭਾਸ਼ਾ ਦੇ ਸ਼ਬਦ ਵੀ ਛੱਡ ਜਾਂਦੇ ਨੇ ਤਾਂ ਜਿਹਨਾਂ ਨਾਲ ਕਿ ਉਹਨਾਂ ਨੂੰ ਸਮਝ ਆਉਂਦੀ ਹੈ ਤਾਂ ਜੇਕਰ ਉਹਨਾਂ ਨੂੰ ਕੋਈ ਹੋਰ ਭਾਸ਼ਾ ਦੀ ਜ਼ਰੂਰਤ ਹੈ ਜਾਂ ਕੋਈ ਹੋਰ ਵਿਦੇਸ਼ੀ ਆਉਂਦਾ ਹੈ ਤਾਂ ਪੰਜਾਬੀਆਂ ਦੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਬੋਲ ਕੇ ਜਿਹੜਾ ਹੈ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਭਾਸ਼ਾ ਉਹਨਾਂ ਨੂੰ ਸਮਝਾਈ ਜਾਵੇ ਆਪਣੀ ਜਿਹੜੇ ਦਿਲ ਦੀਆਂ ਗੱਲਾਂ ਨੇ ਆਪਣੇ ਜਿਹੜੇ ਕੰਮ ਕਰਵਾਉਣ ਦੇ ਤਰੀਕੇ ਨੇ ਉਹਨਾਂ ਤੱਕ ਸਾਂਝੇ ਕੀਤੇ ਜਾਣ